ਸੰਸਾਰ ਪੱਧਰ ਉੱਪਰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਨਾਚ ਬੈਲਟ ਹੈ ਜਿਸ ਨੂੰ ਲੋਕਾਂ ਦੁਆਰਾ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਸੰਸਾਰ ਪੱਧਰ ਉੱਪਰ ਪ੍ਰਸਿੱਧ ਨਾਚ ਹਿੱਪ ਹੋਪ ਭਰਤ ਨਾਟਿਅਮ ਸਾਲਸਾ ਬੈਲਰੂਮ ਕੰਟੈਪਰਰੀ ਬਰੇਕ ਡਾਂਸ ਜੈਜ਼ ਅਤੇ ਕੱਥਕ ਆਦਿ ਹਨ ਭਾਰਤ ਦੇਸ਼ ਦੇ ਪ੍ਰਸਿੱਧ ਨਾਚ ਭੰਗੜਾ ਗਿੱਧਾ ਡਫ ਧਮਾਲ ਘੂਮਰ ਝਾਕਰੀ ਗੰਗੌਰ ਸਿਕਮਰੀ ਕੁਮੀ ਕੌਲਾਤਮ ਆਦਿ ਹਨ ਹਰ ਰਾਜ ਜਾਂ ਦੇਸ਼ ਦਾ ਆਪਣਾ ਆਪਣਾ ਲੋਕ ਨਾਚ ਹੈ ਅਤੇ ਇਹਨਾਂ ਲੋਕ ਨਾਚ ਪਿੱਛੇ ਸਭ ਦੀਆਂ ਆਪਣੀਆਂ ਆਪਣੀਆਂ ਧਾਰਮਿਕ ਸਮਾਜਿਕ ਅਤੇ ਸੱਭਿਆਚਾਰਕ ਮਹੱਤਤਾਵਾਂ ਹਨ ਇਸ ਲਈ ਕਿਸੇ ਇੱਕ ਨਾਚ ਬਾਰੇ ਅਤੇ ਉਸ ਦੀ ਮਹੱਤਤਾ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਹਰ ਇਨਸਾਨ ਦੀਆਂ ਆਪਣੇ ਲੋਕ ਨਾਚ ਨਾਲ ਕੁਝ ਖ਼ਾਸ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ